ਕੋਈ ਵੀ ਬਦਲਾਅ ਨੂੰ ਸਾਡੀ ਸੁਸਾਇਟੀ ਜਲਦੀ ਜਲਦੀ ਅਕਸੈਪਟ ਨਹੀਂ ਕਰਦੀ ਜਲਦੀ ਜਲਦੀ ਉਹਨਾਂ ਨੂੰ ਅਪਣਾਉਂਦੀ ਨਹੀਂ ਇਸ ਲਈ ਜਿਹੜੇ ਪਿਛਲੇ ਹਿੱਤਾਂ ਦੇ ਦਿਹਾਤੀ ਖੇਤਰ ਹੁੰਦੇ ਹਨ ਉਨ੍ਹਾਂ ਨੂੰ ਇੱਕ ਤਾਂ ਪੜ੍ਹਾਈ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਹੈ ਕਿ ਉਹ ਘੱਟ ਪੜ੍ਹੇ ਹੋਣ ਕਰਕੇ ਉਹ ਅਪਣਾਉਂਦੇ ਨਹੀਂ ਟੈਕਨੋਲਜੀ ਨੂੰ ਬਹੁਤ ਮੁਸ਼ਕਿਲ ਨਾਲ ਅਪਣਾਉਂਦੇ ਹਨ ਉਨ੍ਹਾਂ ਨੂੰ ਇੱਕ ਤਾਂ ਸਮਝਣ ਅਤੇ ਸਿੱਖਣ ਲਈ ਟੈਕਨੋਲਜੀ ਨੂੰ ਸਿੱਖਣ ਵਿੱਚ ਥੋੜ੍ਹੀ ਅਖੁਆਈ ਹੁੰਦੀ ਹੈ ਦੂਜੀ ਗੱਲ ਇਹ ਹੈ ਕਿ ਟੈਕਨੋਲਜੀ ਦਾ ਗਲਤ ਯੂਜ਼ ਵੀ ਬਹੁਤ ਹੋ ਸਕਦਾ ਹੈ ਇਸ ਲਈ ਉਸ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈ ਦਿਹਾਤੀ ਖੇਤਰਾਂ ਦੇ ਜਿਹੜੇ ਲੋਕ ਹਨ ਉਹ ਜ਼ਿਆਦਾਤਰ ਗਾਣੇ ਹੀ ਸੁਣਦੇ ਹਨ ਜਾਂ ਫਿਲਮਾਂ ਦੇਖਣ ਦੇ ਵਿੱਚ ਹੀ ਪ੍ਰਯੋਗ ਕਰਦੇ ਹਨ ਕੋਈ ਚੰਗਾ ਯੂਜ਼ਫੁੱਲ ਉਪਯੋਗ ਨਹੀਂ ਕਰਦੇ ਹਨ ਕਈ ਵਾਰ ਓਪਟੀਕਲ ਫਾਈਬਰ ਦੀ ਤਾਰਾਂ ਪਾਉਣੀਆਂ ਹੋਣ ਜਾਂ ਕੋਈ ਨਵੀਂ ਤਕਨੌਲਜੀ ਯੂਜ਼ ਕਰਨ ਲਈ ਕੋਈ ਓਪਟੀਕਲ ਲਗਾਉਣੇ ਹੋਣ ਤਾਂ ਉਸ ਨੂੰ ਲਗਾਉਣ ਲਈ ਬਹੁਤ ਅਖੁਆਈ ਹੁੰਦੀ ਹੈ ਉਨ੍ਹਾਂ ਲੋਕਾਂ ਨੂੰ ਆਪਣੇ ਹੱਕ ਹਿੱਤਾਂ ਵਿੱਚ ਬੰਦਿਆਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ